ਹੈਲੋ ਸਤਿ ਸ਼੍ਰੀ ਅਕਾਲ ਮੈਡਮ ਜੀ ਮੈਡਮ ਮੈਂ ਨਾ ਇੰਟਰਨੈਟ 'ਤੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਖਾਣੇ ਹੁੰਦੇ ਨੇ ਉਹ ਅਲੱਗ ਅਲੱਗ ਜਗ੍ਹਾ ਤੋਂ ਵੇਖ ਕੇ ਇੰਟਰਨੈਟ 'ਤੇ ਮੈਂ ਪਾਉਂਦੀ ਹਾਂ ਅਤੇ ਮੈਂ ਜਿਹੜੀ ਹਾਂ ਰਾਜਸਥਾਨ ਦੀ ਰਹਿਣ ਵਾਲੀ ਹਾਂ ਪਰ ਮੈਂ ਪੰਜਾਬ 'ਚ ਆ ਕੇ ਇਹ ਸਭ ਚੀਜ਼ਾਂ ਰਿਕੋਡ ਕਰਨਾ ਚਾਹੁੰਦੀ ਹਾਂ ਆਪਣੇ ਫੋਨ ਦੇ ਵਿੱਚ ਤਾਂ ਜੋ ਮੈਂ ਇੰਟਰਨੈਟ 'ਤੇ ਪਾ ਸਕਾਂ ਕਿ ਗੁਰਦਾਸਪੁਰ ਦੇ ਕਿਹੜੇ ਕਿਹੜੇ ਇਲਾਕੇ ਵਿੱਚੋਂ ਕਿਹੜੀ ਕਿਹੜੀ ਜਗ੍ਹਾ ਤੋਂ ਕੁਛ ਵਧੀਆ ਖਾਣ ਨੂੰ ਮਿਲਦਾ ਹੈ ਠੀਕ ਹੈ ਮੈਡਮ ਠੀਕ ਹੈ ਮੈਡਮ ਮੈਮ ਬਹੁਤ ਬਹੁਤ ਧੰਨਵਾਦ ਤੁਹਾਡਾ ਮੈਨੂੰ ਮਾਰਗ ਦਰਸ਼ਨ ਦੇਣ ਦੇ ਲਈ ਅਤੇ ਅਗਰ ਮੈਂ ਗੁਰਦਾਸਪੁਰ ਜ਼ਿਲ੍ਹੇ ਵਿੱਚ ਆਵਾਂਗੀ ਤਾਂ ਤੁਸੀਂ ਮੈਨੂੰ ਜ਼ਰੂਰ ਆਪਣੇ ਨਾਲ ਲੈ ਕੇ ਉਸ ਜਗ੍ਹਾ 'ਤੇ ਜਾਇਓ ਠੀਕ ਹੈ ਓਕੇ ਠੀਕ ਹੈ ਧੰਨਵਾਦ ਮੈਡਮ ਓਕੇ ਬਾਏ